ਅੰਮ੍ਰਿਤਸਰ ਦੇ ਵਿੱਚ ਕਈ ਟਰੈਵਲਰ ਕੰਪਨੀਆਂ ਕੰਮ ਕਰਦੀਆਂ ਹਨ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਉਹਨਾਂ ਵਿੱਚ ਗੋਲਡਨ ਟੂਲਿਪ ਕੰਪਨੀ ਬਹੁਤ ਵਧੀਆ ਹੈ ਜੋ ਕਿ ਵੋਲਵੋ ਬੱਸਾਂ ਨੂੰ ਚਲਾਉਂਦੀ ਹੈ ਇਸ ਸ ਇਹਨਾਂ ਦੀਆਂ ਬੱਸਾਂ ਦਿੱਲੀ ਜੰਮੂ ਅਤੇ ਭਾਰਤ ਦੇ ਹੋਰ ਵੱਖ ਵੱਖ ਥਾਵਾਂ 'ਤੇ ਵੀ ਜਾਂਦੀਆਂ ਹਨ ਔਰ ਇਹਨਾਂ ਦੀ ਬਹੁਤ ਹੀ ਕਫਾਇਤੀ ਟਿਕਟ ਹੈ ਬਹੁਤ ਹੀ ਰਿਆਇਤੀ ਦਰਾਂ ਦੇ ਉੱਤੇ ਮੁਸਾਫਰਾਂ ਨੂੰ ਸਫ਼ਰ ਕਰਾਉਂਦੀਆਂ ਹਨ ਇਹਨਾਂ ਤੋਂ ਇਲਾਵਾ ਜੋ ਲੋਕਲ ਬੱਸ ਸਰਵਿਸ ਹਨ ਜਿਨ੍ਹਾਂ ਵਿੱਚ ਕਰਤਾਰ ਬੱਸ ਸਰਵਿਸ ਦੀਪ ਬੱਸ ਸਰਵਿਸ ਇਹ ਲੋਕਲ ਬੱਸ ਸਰਵਿਸਿਜ਼ ਹਨ ਇਹਨਾਂ ਦੇ ਰਾਹੀਂ ਵੀ ਮੁਸਾਫਰਾਂ ਨੂੰ ਸਫਰ ਕਰਨਾ ਬਹੁਤ ਹੀ ਰਿਆਇਤੀ ਦਰਾਂ ਉੱਪਰ ਮਿਲਦਾ ਹੈ ਇਹਨਾਂ ਬੱਸਾਂ ਦੇ ਨਾਲ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਘੁੰਮਿਆਂ ਜਾ ਸਕਦਾ ਹੈ ਅਤੇ ਵਾਹਗਾ ਬਾਰਡਰ ਡੇਰਾ ਬਾਬਾ ਨਾਨਕ ਪਠਾਨਕੋਟ ਅੰਮ੍ਰਿਤਸਰ ਦੇ ਜੋ ਲੋਕਲ ਇਲਾਕੇ ਹਨ ਉਹਨਾਂ ਵਿੱਚ ਸਥਿਤ ਥਾਵਾਂ ਦੇ ਉੱਤੇ ਘੁੰਮਿਆਂ ਜਾ ਸਕਦਾ ਹੈ ਇਹਨਾਂ ਨੂੰ ਬੁੱਕ ਕਰਨ ਦੇ ਵਾਸਤੇ ਅੰਮ੍ਰਿਤਸਰ ਦੇ ਬੱਸ ਸਟੈਂਡ ਉੱਪਰ ਇਹਨਾਂ ਦੇ ਦਫਤਰ ਬਣੇ ਹੋਏ ਹਨ ਜਿੱਥੇ ਇਹਨਾਂ ਨੂੰ ਬੁੱਕ ਕੀਤਾ ਜਾ ਸਕਦਾ ਹੈ